ਮੈਂ ਭਾਰਤ ਦੀਆਂ ਕੁਝ ਥਾਵਾਂ 'ਤੇ ਸਾਈਕਲ ਰਾਹੀਂ ਗਿਆ ਹਾਂ ਜਿਵੇਂ ਕਿ ਨੈਣਾਂ ਦੇਵੀ ਅਨੰਦਪੁਰ ਸਾਹਿਬ ਬਾਬਾ ਬਾਲਕ ਨਾਥ ਇਹ ਜੀ ਥਾਵਾਂ 'ਤੇ ਜਾ ਚੁੱਕੇ ਹਨ ਅਤੇ ਮੈਨੂੰ ਨਾ ਸਾਈਕਲ ਦਾ ਸ਼ੁਰੂ ਤੋਂ ਹੀ ਬਹੁਤ ਸ਼ੌਂਕ ਹੈ ਮੈਨੂੰ ਘੁੰਮਣ ਦਾ ਵੀ ਬਹੁਤ ਸ਼ੌਂਕ ਹੈ ਹੁਣ ਮੇਰਾ ਇੱਕ ਸੁਪਨਾ ਹੈ ਕਿ ਮੈਂ ਨਾ ਜਾਣਾ ਚਾਹੁੰਦਾ ਪੂਰਾ ਇੰਡੀਆ ਘੁੰਮਣਾ ਚਾਹੁੰਦਾ ਜਿਵੇਂ ਸਾਈਕਲ 'ਤੇ ਜਿੱਦਾਂ ਲਦਾਖ ਹੋ ਗਿਆ ਕਸ਼ਮੀਰ ਹੋ ਗਿਆ ਗੋਆ ਹੋ ਗਿਆ ਬੋਂਬੇ ਹੋ ਗਿਆ ਵਰਿੰਦਾਵਨ ਹੋ ਗਿਆ ਦਿੱਲੀ ਸਾਰੀ ਜਗ੍ਹਾ ਘੁੰਮਣ ਚਾਹੁੰਦਾ ਜਿੱਥੇ ਕਿ ਸ਼ਾਂਤੀ ਮਿਲੇ ਵਧੀਆ ਤਰੀਕੇ ਨਾਲ ਘੁੰਮਣਾ ਚਾਹੁੰਦਾ ਏ ਇਹ ਮੇਰਾ ਸਪਨਾ ਏ ਕਿਉਂਕਿ ਮੈਨੂੰ ਸਾਈਕਲ ਚਲਾਉਣਾ ਸ਼ੁਰੂ ਤੋਂ ਹੀ ਬਹੁਤ ਵਧੀਆ ਲੱਗਦਾ ਮੈਨੂੰ ਘੁੰਮਣ ਦਾ ਸ਼ੌਂਕ ਵੀ ਸ਼ੁਰੂ ਤੋਂ ਹੀ ਹੈ ਇਹ ਮੈਨੂੰ ਇੱਕ ਤਰ੍ਹਾਂ ਦਾ ਇੱਕ ਮੇਰਾ ਇਹ ਸੁਪਨਾ ਨਹੀਂ ਹੈ ਇੱਕ ਤਰ੍ਹਾਂ ਦਾ ਮੇਰਾ ਇਹ ਸ਼ੌਂਕ ਹੈ ਇੱਕ ਇਹ ਸ਼ੌਂਕ ਪੂਰਾ ਮੈਂ ਕਰਨਾ ਚਾਹੁੰਦਾ ਹੈ ਇਹ ਸ਼ੌਂਕ ਮੇਰਾ ਪੂਰਾ ਹੋਣਾ ਚਾਹੀਦਾ ਮੈਨੂੰ ਤਾਂ ਲੱਗਦਾ ਕਿ ਜਲਦੀ ਪੂਰਾ ਹੋਏਗਾ ਮੈਂ ਬਹੁਤ ਸਾਈਕਲ ਦਾ ਸਾਈਕਲ ਦਾ ਇੱਕ ਵਧੀਆ ਬੈਨੀਫਿਟ ਵੀ ਹੈ ਕਿ ਬੰਦਾ ਘੁੰਮਦਾ ਏ ਕੁਛ ਤੇਲ ਦੀ ਵੀ ਨਹੀਂ ਲੱਗਦਾ ਤੇਲ ਤੂਲ ਕੋਈ ਖਰਚਾ ਨਹੀਂ ਬਸ ਆਪਣਾ ਦੇਖਣਾ ਹੁੰਦਾ ਖਰਚੇ ਦੀ ਕੋਈ ਗੱਲ ਏ ਨਹੀਂ ਇਸ ਮੇ